ਸਾਡੇ ਖੇਤਰ ਵਿੱਚ ਗੁਲਗੁਲੇ ਮੱਠੀਆਂ ਸੇਮੀਆਂ ਖੀਰ ਪੂੜੇ ਇਹ ਸਭ ਚੀਜ਼ਾਂ ਮਤਲਬ ਰਿਵਾਇਤੀ ਤੌਰ 'ਤੇ ਬਣਾਈਆਂ ਜਾਂਦੀਆਂ ਹਨ ਅਤੇ ਸਾਡੇ ਘਰ ਵਿੱਚ ਜ਼ਿਆਦਾਤਰ ਸੇਮੀਆਂ ਹੀ ਬਣਾਉਂਦੇ ਹਾਂ ਜਿੱਦਾਂ ਕਿ ਸੇਮੀਆਂ ਬਣਾਉਣ ਲਈ ਮਤਲਬ ਗੁੜ ਦੀ ਚਾਸ਼ਣੀ ਉਬਾਲ ਲਓ ਅਤੇ ਸੇਮੀਆਂ ਨੂੰ ਹਲਕੇ ਜਿਹੇ ਘਿਓ ਵਿੱਚ ਭੁੰਨ ਲਵੋ ਜਦੋਂ ਉਹ ਹਲਕੀਆਂ ਜਿਹੀਆਂ ਭੁੰਨ ਜਾਣ ਤਾਂ ਉਨ੍ਹਾਂ ਨੂੰ ਗੁੜ ਦੀ ਚਾਸ਼ਣੀ ਵਾਲੇ ਪਾਣੀ ਨੂੰ ਸੇਮੀਆਂ ਵਿੱਚ ਪਾ ਲਵੋ ਅਤੇ ਉਹਦੇ ਵਿੱਚ ਲੌਂਗ ਇਲਾਇਚੀ ਪਾ ਕੇ ਹਲਕਾ ਜਿਹਾ ਘਿਓ ਪਾ ਕੇ ਉਨ੍ਹਾਂ ਨੂੰ ਮਿਕਸ ਕਰ ਲਵੋ ਅਤੇ ਫਿਰ ਸਾਡੀਆਂ ਸੇਮੀਆਂ ਬਣ ਕੇ ਤਿਆਰ ਹਨ ਇਹ ਸੇਮ ਇਹ ਸੇਮੀਆਂ ਮੇਰੇ ਸਹੁਰਾ ਸਾਹਿਬ ਜੀ ਅਤੇ ਸਾਡੇ ਘਰ ਦਾ ਹਰ ਇੱਕ ਮੈਂਬਰ ਬੜੇ ਹੀ ਚਾਅ ਨਾਲ ਖਾਂਦਾ ਹੈ ਜਿਹਨਾਂ ਨੂੰ ਬਹੁਤ ਪਸੰਦ ਹਨ ਅਤੇ ਸਾਡੇ ਘਰ ਵਿੱਚ ਸਾਰੇ ਹੀ ਬਹੁਤ ਹੀ ਸ਼ੌਕ ਨਾਲ ਸੇਮੀਆਂ ਖਾਂਦੇ ਹਨ ਮੇਰੇ ਸੋਹਰਾ ਜੀ ਸੋਹਰਾ ਸਾਹਿਬ ਜੀ ਬਹੁਤ ਹੀ ਪੁਰਾਣੇ ਖਿਆਲ ਦੇ ਹਨ ਇਸ ਕਰਕੇ ਉਨ੍ਹਾਂ ਨੂੰ ਗੁਲਗੁਲੇ ਮੱਠੀਆਂ ਸੇਮੀਆਂ ਖੀਰ ਪੂੜੇ ਆਦਿ ਇਹ ਸਭ ਚੀਜ਼ਾਂ ਖਾਣ ਦਾ ਬਹੁਤ ਹੀ ਸ਼ੌਕ ਹੈ ਜਿਹਨਾਂ ਦੇ ਕਾਰਨ ਅਸੀਂ ਵੀ ਉਹ ਸਭ ਚੀਜ਼ਾਂ ਬਣਾਉਣ ਦੇ ਵਿੱਚ ਬਹੁਤ ਹੀ ਅਨੰਦ ਮਾਣਦੇ ਹਾਂ ਅਤੇ ਬੜੇ ਹੀ ਚਾਅ ਦੇ ਨਾਲ ਬਣਾਉਂਦੇ ਹਾਂ ਇਸ ਕਰਕੇ ਹਮੇਸ਼ਾ ਵਾਸਤੇ ਇਹ ਸ ਪੁਰਾਣੇ ਖਿਆਲਾਂ ਦੀਆਂ ਪੁਰਾਣੀਆਂ ਚੀਜ਼ਾਂ ਬਣਾਉਣ ਵਿੱਚ ਸਾਨੂੰ ਬਹੁਤ ਹੀ ਵਧੀਆ ਲੱਗਦਾ ਹੈ